ਮੈ ਜੀ ਏਸਰ ਕੰਪਨੀ ਦਾ ਲੈਪਟੋਪ ਲਿਆ ਸੀ ਫਲਿੱਪਕਾਟ ਤੋਂ ਉਹ ਇੱਕ ਵਾਜਬ ਰੇਟ 'ਤੇ ਮਿਲ ਗਿਆ ਸੀਗਾ ਅਤੇ ਇੱਕ ਉਹਦੇ ਵਿੱਚ ਖੂਬੀਆਂ ਬਹੁਤ ਸੀਗੇ ਉਹਨਾਂ ਨੇ ਆਪਣੀ ਉਹਦੀ ਕਵਰਿੰਗ ਬਹੁਤ ਸੋਹਣੀ ਕੀਤੀ ਸੀਗੀ ਅਤੇ ਜਦੋਂ ਉਹਨੂੰ ਮੈਂ ਅਨਪੈਕਿੰਗ ਕੀਤੀ ਤਾਂ ਬੜਾ ਇਜ਼ੀਲੀ ਅਨਪੈਕ ਹੋ ਗਿਆ ਉਹ ਕੋਈ ਸਕਰੈਚ ਨਹੀਂ ਸੀਗਾ ਉਹਦੇ ਵਿੱਚ ਅਤੇ ਜਦੋਂ ਮੈਂ ਚਲਾਇਆ ਉਹ ਨਾਲ ਹੀ ਔਨ ਹੋ ਗਿਆ ਅਤੇ ਮੈਨੂੰ ਉਹ ਛੇ ਮਹੀਨੇ ਹੋ ਗਏ ਯੂਜ਼ ਕਰਦੇ ਨੂੰ ਮੈਨੂੰ ਹਾਲੇ ਤੱਕ ਕੋਈ ਦਿੱਕਤ ਨਹੀਂ ਹੈਗੀ ਅਤੇ ਮੈਂ ਉਹਦੀ ਰੇਟਿੰਗ ਵੀ ਬਹੁਤ ਅੱਛੀ ਦਿੱਤੀ ਅਤੇ ਮੈਂ ਬਾਕੀ ਲੋਕਾਂ ਨੂੰ ਵੀ ਰਿਕਮੈਂਡ ਕਰਦਾ ਹਾਂ ਕਿ ਕੰਪਨੀ ਬਹੁਤ ਵਧੀਆ ਹੈ ਅਤੇ ਔਨਲਾਈਨ ਆਪਣਾ ਬੇਫਿਕਰ ਹੋ ਕੇ ਔਡਰ ਕਰੋ ਅਤੇ ਅਗਰ ਤੁਹਾਨੂੰ ਕੋਈ ਦਿੱਕਤ ਵੀ ਆਉਂਦੀ ਹੈ ਤਾਂ ਇਹ ਕਸਟਮਰ ਕੇਅਰ ਨੰਬਰ ਹੈ ਅਤੇ ਜਦੋਂ ਤੁਸੀਂ ਕਸਟਮਰ ਕੇਅਰ 'ਤੇ ਗੱਲ ਕਰੋਗੇ ਤਾਂ ਚੌਵੀ ਘੰਟੇ 'ਚ ਤੁਹਾਡਾ ਹੱਲ ਹੋ ਜੇਗਾ ਅਤੇ ਇਸ ਲਈ ਮੈਂ ਰਿਕਮੈਂਡ ਕਰਦਾ ਹਾਂ ਅਤੇ ਤੁਸੀਂ ਔਨਲਾਈਨ ਖਰੀਦੋ ਬੇਝਿੱਜਕ ਖਰੀਦੋ ਅਤੇ ਉਹਨੂੰ ਵਰਤੋ